ਜੇ ਮੈਨੂੰ ਕੋਈ ਐਪ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਪੰਜਾਬ ਦੇ ਲੋਕਾਂ ਲਈ ਸਵੱਸਥ ਪੰਜਾਬ ਬਣਾਉਣ ਦੀ ਹੈਲਥ ਐਪ ਬਣਾਵਾਂਗਾ ਇਸ ਐਪ ਦੇ ਫੀਚਰ ਵਿੱਚ ਹੈਲਥ ਟਰੈਕ ਪੰਜਾਬ ਵਿਸ਼ੇਸ਼ ਹੈਲਥ ਟਿਪਸ ਦੇ ਲੋਕਲ ਡਾਕਟਰਾਂ ਦੀ ਡਿਸਪੈਂਸਰੀ ਜਿੱਥੇ ਲੋਕ ਆਨਲਾਈਨ ਕੰਸਲਟੇਸ਼ਨ ਲੈ ਸਕਦੇ ਹਨ ਲੋਕਲ ਫਾਰਮੈਸੀ ਕਲੀਨਿਕ ਅਤੇ ਹਸਪਤਾਲਾਂ ਦੀ ਜਾਣਕਾਰੀ ਅਤੇ ਪੰਜਾਬੀ ਸਟਾਇਲ ਯੋਗਾ ਅਤੇ ਫਿਟਨੈਸ ਰੂਟੀਨ ਸ਼ਾਮਿਲ ਹੋਣਗੇ ਇਸ ਦਾ ਮਕਸਦ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੀ ਸਿਹਤ ਨੂੰ ਇੰਪਰੂਵ ਕਰਨ ਲਈ ਪੰਜਾਬੀ ਭਾਸ਼ਾ ਵਿੱਚ ਸਿਹਤ 'ਤੇ ਰਿਸੋਰਸ ਦੇਣਾ ਹੋਵੇਗਾ ਇਸ ਐਪ ਦੀ ਸਹਾਇਤਾ ਨਾਲ ਲੋਕ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਪ੍ਰਤੀ ਦਿਨ ਟਰੈਕ ਕਰ ਸਕਦੇ ਹਨ ਇਹਨਾਂ ਨੂੰ ਸਿਹਤ ਖਾਣ ਪੀਣ ਅਤੇ ਯੋਗਾ ਬਾਰੇ ਸਹੀ ਜਾਣਕਾਰੀ ਮਿਲੇਗੀ ਜੇ ਉਹਨਾਂ ਦੀ ਰੋਜ਼ਾਨਾ ਦੀ ਲਾਈਫ ਸਟਾਈਲ ਹੈਬਿਟਸ ਨੂੰ ਸਹੀ ਰਸਤੇ 'ਤੇ ਲਿਆਵਾਂਗੇ ਇਸ ਐਪ ਦੇ ਜ਼ਰੀਏ ਲੋਕਾਂ ਨੂੰ ਆਪਣੀ ਸਿਹਤ ਸੰਭਾਲਣ ਲਈ ਸਿਖਲਾਈ ਮਿਲੇਗੀ ਜੇ ਉਹਨਾਂ ਨੂੰ ਸਿਰਫ਼ ਚੰਗੀ ਸਿਹਤ ਦੇ ਨਾਲ ਹੀ ਸਹਾਇਤਾ ਦੇਵਾਂਗੇ ਪਰ ਉਹ ਆਪਣੇ ਘਰੇਲੂ ਮਜਦੇ ਵੀ ਆਪਣੀ ਸਿਹਤ ਸਬੰਧੀ ਗੱਲਾਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਇਹ ਐਪ ਬਿਹਤਰ ਬਾਰੇ ਲੋਕਾਂ ਨੂੰ ਜਾਗਰੁਕਤਾ ਨੂੰ ਨੂੰ ਵਧਾਵਾ ਦੇਵੇਗੀ ਜਿਵੇਂ ਕਿ ਬਿਮਾਰੀਆਂ ਤੋਂ ਬਚਾਅ ਸਿਹਤਮੰਦ ਖਾਣਾ ਦੀਆਂ ਆਦਤਾਂ ਰੋਜ਼ ਵਰਜਿਸ਼ ਕਰਨਾ ਇਸ ਨਾਲ ਸਾਡੀ ਤਿਆਰੀ ਸਮੇਤ ਸੁਖ ਚਿੰਤਾ ਮੁਕਤ ਜੀਵਨ ਨੂੰ ਆਪਣੇ ਨਾਲ ਜਿਉਣਾ ਇਸ ਐਪ ਨਾਲ ਸਿੱਧਾ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਹੋਈਆਂ ਜਿੱਥੇ ਉਹ ਸਿਹਤਮੰਦ ਅਤੇ ਪ੍ਰ੍ਕ੍ਰਿਤਿਕ ਜੀਵਨ ਦੇ ਤਰੀਕੇ ਸਿੱਖਣਗੇ ਇਹ ਐਪ ਹਰ ਉਮਰ ਦੇ ਲੋਕਾਂ ਲਈ ਸੁਵਿਧਾਜਨਕ ਹੋਵੇਗੀ ਜਿਵੇਂ ਕਿ ਬੱਚਿਆਂ ਤੋਂ ਲੈ ਕੇ ਵੱਡੇ ਉਮਰ ਦੇ ਬੱਚੇ ਵੱਡੇ ਉਮਰ ਦੇ ਲੋਕ ਵੀ ਇਹ ਜਿਹਨਾਂ ਨੂੰ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਲੋੜ ਹੁੰਦੀ ਹੈ ਸਿਹਤ ਦੇ ਮਾਮਲੇ 'ਚ ਕਈ ਜਾਣਕਾਰੀਆਂ ਦੀ ਘਾਟ ਹੋਣ ਦੀ ਵਜ੍ਹਾ ਨਾਲ ਲੋਕ ਗਲਤ ਫੈਸਲੇ ਲੈਂਦੇ ਹਨ ਪਰ ਇਸ ਐਪ ਦੁਆਰਾ ਉਹ ਸਹੀ ਰਾਹ 'ਤੇ ਜਾ ਸਕਦੇ ਹਾਂ ਇਸ ਵਿੱਚ ਖ਼ਾਸ ਫੀਚਰ ਹੋਣਗੇ ਕਿ ਜਿਵੇਂ ਮਸ਼ਰੂਫ ਲੋਕ ਲਈ ਸਿਹਤ ਮੰਦ ਰੈਸਪੀ ਛੋਟੇ ਅਤੇ ਆਸਾਨ ਵਰਜਿਸ਼ਾਂ ਦੀ ਸੂਚੀ ਅਤੇ ਲੋਕਾਂ ਨੂੰ ਆਪਣੀ ਸਿਹਤ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕਰਨ ਲਈ ਮੁਕਾਬਲੇ ਅਤੇ ਚੁਣੌਤੀਆਂ